ਮੈਂ ਵਾਇਰ ਕਟਰ ਓਡਰ ਕੀਤਾ ਸੀਗਾ ਇੱਕ ਐਮਾਜ਼ੋਨ ਤੋਂ ਅਤੇ ਉਹ ਕਾਫੀ ਮਦਦਫੁੱਲ ਰਿਹਾ ਮੇਰੇ ਲਈ ਕਿਸੇ ਵਾਇਰ ਨੂੰ ਕੱਟਣ ਲਈ ਕਾਫੀ ਅਸਾਨੀ ਹੋ ਗਈ ਸੀ ਉਹਦੇ ਨਾਲ ਅਤੇ ਕਾਫੀ ਵਧੀਆ ਸੀਗਾ ਉਹ ਅਤੇ ਉਸਨੇ ਕਾਫੀ ਮਦਦ ਕੀਤੀ ਮੇਰੀ ਉਹ ਕਾਫੀ ਮਦਦਫੁੱਲ ਸੀਗਾ